ਅੱਜ ਮੈਂ ਹੇਮਕੁੰਟ ਸਾਹਿਬ ਦੇ ਬਾਰੇ ਦੱਸਣਾ ਚਾਹੂੰਗੀ ਹੇਮਕੁੰਟ ਸਾਹਿਬ ਜੋ ਕਿ ਬਿਹਾਰ ਵਿੱਚ ਸਥਿਤ ਹੈ ਉੱਥੇ ਦੀ ਚੜ੍ਹਾਈ ਬਹੁਤ ਹੀ ਜ਼ਿਆਦਾ ਹੈ ਜ਼ਿਆਦਾਤਰ ਉਹਨਾਂ ਦਿਨਾਂ ਵਿੱਚ ਖੁੱਲਦਾ ਹੈ ਜਦੋਂ ਬਰਫ ਪਈ ਹੁੰਦੀ ਹੈ ਅਤੇ ਉਹਨਾਂ ਦੀ ਚੜ੍ਹਾਈ ਪਹਿਲਾਂ ਤਾਂ ਖੱਚਰਾਂ ਦੇ ਨਾਲ ਕੀਤੀ ਜਾਂਦੀ ਆ ਪਰ ਜੇਕਰ ਅਸੀਂ ਤੁਰ ਕੇ ਜਾਈਏ ਤਾਂ ਉਹ ਵੀ ਜ਼ਿਆਦਾਤਰ ਹੀ ਆਸਾਨ ਨਹੀਂ ਹੁੰਦਾ ਅਤੇ ਉੱਥੇ ਦੇ ਪਹਾੜ ਇੱਦਾਂ ਹੈ ਜੋ ਕਿ ਬਰਫ ਦੇ ਨਾਲ ਢਕੇ ਹੋਏ ਹੁੰਦੇ ਹਨ ਅਤੇ ਇਹ ਪਤਾ ਨਹੀਂ ਲੱਗਦਾ ਹੈਗਾ ਕਿ ਕਿਹੜੇ ਵੇਲੇ ਕਿਹੜੀ ਬਰਫ ਡਿੱਗ ਜਾਣੀ ਹੈ ਉੱਥੇ ਦਾ ਦ੍ਰਿਸ਼ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ